ਹਾਂਜੀ ਸਾਨੂੰ ਲੱਗਦਾ ਹੈ ਕਿ ਨਿਊਜ਼ ਮੀਡੀਆ ਵਾਲੇ ਪੇਂਡੂ ਖੇਤਰਾਂ ਵਿੱਚ ਕਾਫੀ ਮੁੱਦੇ ਦਿਖਾਉਂਦੇ ਹਨ ਪਰ ਉਹ ਅਜਿਹੇ ਮੁੱਦੇ ਨਹੀਂ ਦਿਖਾਉਂਦੇ ਜਿਨ੍ਹਾਂ ਵਿੱਚ ਸੱਚਾਈ ਹੋਵੇ ਨਿਊਜ਼ ਮੀਡੀਆ ਵਾਲੇ ਤਾਂ ਪੁਰਾਣੀ ਖਬਰਾਂ ਨੂੰ ਹੀ ਮਸਾਲੇ ਲਾ ਲਾ ਕੇ ਦਿਖਾਉਂਦੇ ਹਨ ਅਤੇ ਲੋਕਾਂ ਨੂੰ ਗੁੰਮਰਾਹ ਕਰਦੇ ਹਨ ਨਿਊਜ਼ ਮੀਡੀਆ ਵਾਲੇ ਤਾਂ ਆਪਣੇ ਵੱਲੋਂ ਹੀ ਚਾਰ ਗੱਲਾਂ ਲਾ ਕੇ ਦੱਸਦੇ ਹਨ ਤਾਂ ਕਿ ਲੋਕ ਲੋਕਾਂ ਵਿੱਚ ਡਰ ਬਣਿਆ ਰਹੇ ਨਿਊਜ਼ ਮੀਡੀਆ ਵਾਲੇ ਕਦੀ ਵੀ ਪੂਰਾ ਸੱਚ ਨਹੀਂ ਦੱਸਦੇ ਕਦੀ ਵੀ ਪੂਰੇ ਸੱਚ ਨੂੰ ਸਾਹਮਣੇ ਨਹੀਂ ਲਿਆਉਂਦੇ ਉਹ ਅਜਿਹੇ ਗੱਲਾਂ ਤੋਂ ਪਿੱਛੇ ਰਹਿੰਦੇ ਹਨ ਅਤੇ ਉਹ ਆਪਣਾ ਕੰਮ ਕਰਦੇ ਰਹਿੰਦੇ ਹਨ